ਹਾਂ ਸਾਡੇ ਪਿੰਡਾਂ ਦੇ ਲੋਕਾਂ ਲਈ ਕਰਜ਼ਾ ਲੈਣਾ ਆਮ ਗੱਲ ਹੈ ਕਰਜ਼ਾ ਕਰਜ਼ਾ ਇਸ ਲਈ ਲੈਂਦੇ ਹਨ ਕਿ ਸ ਜਮੀਨ ਖੇਤੀ ਵਿੱਚੋਂ ਪੈਸਾ ਤਾਂ ਬਚਦਾ ਨਹੀਂ ਪਰ ਜਦੋਂ ਬੱਚੇ ਦਾ ਵਿਆਹ ਕਰਨਾ ਹੁੰਦਾ ਹੈ ਤਾਂ ਉਹ ਬੈਂਕ ਨਾਲ ਸੰਪਰਕ ਕਰਦੇ ਹਨ ਕਰਜ਼ਾ ਜਦੋਂ ਨਹੀਂ ਮੁੜਦਾ ਤਾਂ ਸਾਡਾ ਕਿਸਾਨ ਖੁਦਕੁਸ਼ੀ ਕਰਦਾ ਹੈ